ਹੈਲੋ ਹਾਂਜੀ ਕੁਲਦੀਪ ਮੈਂ ਹਾਂ ਸਤਿ ਸ਼੍ਰੀ ਅਕਾਲ ਬੱਚੇ ਹੋਰ ਸੁਣਾਓ ਕਿੱਦਾਂ ਤੁਸੀਂ ਅੱਜ ਸਕੂਲ ਨਹੀਂ ਆਏ ਅੱਛਾ ਅੱਛਾ ਇੱਦਾਂ ਆ ਇਸ ਤਰ੍ਹਾਂ ਬੱਚੇ ਕਿ ਅਸੀਂ ਇਹਨਾਂ ਨੈਕਸਟ ਮੰਥ ਐਨੁਅਲ ਫੰਕਸ਼ਨ ਮਨਾ ਰਹੇ ਹਾਂ ਤਾਂ ਉਸ ਦੇ ਵਿੱਚ ਨਾ ਮੈਂ ਕੁਛ ਆਈਡੀਆ ਜਿਹਾ ਆਇਆ ਸੀਗਾ ਕਿ ਆਪਾਂ ਫਰੀਡਮ ਫਾਈਟਰ ਦੇ ਜਿਹੜੇ ਸ ਸਾਡੇ ਸੰਘਰਸ਼ ਸੰਗਰਾਮੀ ਹੈ ਉਹਨਾਂ ਲਈ ਇੱਕ ਰੋਲ ਸਲੈਕਟ ਕੀਤਾ ਸੀਗਾ ਜਿੱਦਾਂ ਭਗਤ ਸਿੰਘ ਸੁਖਦੇਵ ਰਾਜਗੁਰੂ ਸੁਭਾਸ਼ ਚੰਦਰ ਬੋਸ ਹੈ ਨਾ ਉਹ ਉਹਨਾਂ ਫਰੀਡਮ ਫਾਈਟਰ ਨੇ ਜੋ ਵੀ ਆਜ਼ਾਦੀ ਦੇ ਵਿੱਚ ਘਾਲਣਾ ਕੀਤੀ ਆਪਣਾ ਸੰਘਰਸ਼ ਦੇ ਰੂਪ ਦੇ ਵਿੱਚ ਜੋ ਵੀ ਉਹਨਾਂ ਨੇ ਯੋਗਦਾਨ ਪਾਇਆ ਹਾਂਜੀ ਉਹਦੇ ਬਾਰੇ ਸਪੀਚ ਤਿਆਰ ਕਰਨੀ ਆ ਅਤੇ ਹਾਂਜੀ ਇਸ ਕਰਕੇ ਮੈਂ ਤੈਨੂੰ ਲੱਭ ਰਹੀ ਸੀਗੀ ਫਿਰ ਮੈਨੂੰ ਮੇਰੀ ਕਲਾਸ ਟੀਚਰ ਨੇ ਦੱਸਿਆ ਕਿ ਤੁਸੀਂ ਅੱਜ ਗੈਰ ਹਾਜ਼ਰ ਸੀਗੇ ਤਾਂ ਉਹਨਾਂ ਤੋਂ ਮੈਂ ਤੁਹਾਡਾ ਨੰਬਰ ਲਿਆ ਫਿਰ ਅ ਹਾਂਜੀ ਹਾਂਜੀ ਅਤੇ ਤੁਸੀਂ ਇਸ ਟੋਪਿਕ ਨੂੰ ਤਿਆਰ ਕਰ ਲਓਗੇ ਜੋ ਵੀ ਉਹਨਾਂ ਨੇ ਯੋਗਦਾਨ ਪਾਇਆ

ਜੀ ਹਾਂਜੀ ਜਿੰਨੀ ਕੁ ਤੁਹਾਨੂੰ ਜਾਣਕਾਰੀ ਮਿਲੇਗੀ ਹਾਂਜੀ ਤੁਸੀਂ ਬੱਚੇ ਇੱਦਾਂ ਕਰਿਓ ਕਿ ਨਾ ਹਾਂਜੀ ਦੋ ਅਤੇ ਨਾ ਦੋ ਨਾ ਦੋ ਫਰੀਡਮ ਫਾਈਟਰ 'ਤੇ ਲਿਖ ਲਿਓ ਤਾਂ ਕਿ ਫਿਰ ਉਸ ਨੂੰ ਆਪਾਂ ਜਦੋਂ ਤੁਸੀਂ ਸਕੂਲ ਆਉਗੇ ਇੱਕ ਦੋ ਦਿਨ ਤੱਕ ਤੁਹਾਡੇ ਕੋਲ ਟਾਈਮ ਹੈਗਾ ਆ ਤੁਸੀਂ ਲਿਖ ਕੇ ਉਹਨੂੰ ਮਤਲਬ ਪੜ੍ਹ ਕੇ ਦੇਖ ਲਿਓ ਫਿਰ ਮੈਨੂੰ ਦੋ ਤਿੰਨ ਦਿਨ ਤੱਕ ਚੈੱਕ ਕਰਵਾ ਕੇ ਨਾ ਫਿਰ ਮੈਂ ਤੁਹਾਨੂੰ ਦੱਸ ਦਵਾਂਗੀ ਕਿ ਕਿਸ ਉੱਪਰ ਤੁਸੀਂ ਵਧੀਆ ਬੋਲ ਰਹੇ ਆ ਹੈ ਨਾ ਤਾਂ ਵੀ ਫਿਰ ਉਹ ਹਾਂਜੀ ਇੱਦਾਂ ਲਿਖ ਜਿੱਦਾਂ ਆਪਾਂ ਅੱਠ ਦਸ ਫਰੀਡਮ ਫਾਈਟਰ ਬਾਰੇ ਲਿਖ ਕੇ ਪਰ ਜਿਹੜਾ ਸਾਡਾ ਮੇਨ ਮੁੱਦਾ ਹੋਏਗਾ ਉਹ ਕਿਸੇ ਇੱਕ ਫਰੀਡਮ ਫਾਈਟਰ 'ਤੇ ਹੋਏਗਾ ਜਿਸ ਵੀ ਆਪਾਂ ਮਤਲਬ ਜਿਹੜੀ ਜਨਮ ਤੋਂ ਲੈ ਕੇ ਉਸਦੀ ਸ਼ਹੀਦੀ ਦਿਨ ਤੱਕ ਦਾ ਪੂਰਾ ਫਿਰ ਉਹ 'ਤੇ ਚਾਨਣਾ ਪਾਵਾਂਗੇ ਕਿਉਂਕਿ ਆਪ ਹਾਂਜੀ ਹਾਂਜੀ ਹਾਂ ਜਿੱਦਾਂ ਜਦੋਂ ਉਹਨਾਂ ਨੇ ਪੜ੍ਹਾਈ ਵੀ ਆਪਣੀ ਪੜ੍ਹਾਈ ਦੇ ਦੌਰਾਨ ਉਹਨਾਂ ਨੇ ਬਹੁਤ ਸਾਰੇ ਮਤਲਬ ਇੱਦਾਂ ਦੇ ਉਹਨਾਂ ਦੇ ਕਿੱਸੇ ਆ ਜਿਹੜੇ ਬਹੁਤ ਮਸ਼ਹੂਰ ਆ ਕਿ ਉਹਨਾਂ ਨੇ ਕਿਵੇਂ ਆਜ਼ਾਦੀ ਦੇ ਵਿੱਚ ਆਪਣਾ ਯੋਗਦਾਨ ਦਿੱਤਾ ਨਾ ਇਹਨਾਂ ਸਾਰਿਆਂ ਦਾ ਆਪਾਂ ਨਿਚੋੜ ਕੱਢ ਕੇ ਦੋ ਤੋਂ ਤਿੰਨ ਪੇਜਾਂ ਪੇਜਾਂ ਦਾ ਲਿਖਣਾ ਆ ਤਾਂ ਕਿ ਜਦੋਂ ਮਾਪੇ ਵੀ ਆਉਣਗੇ ਆਪਾਂ ਉਹਨਾਂ ਦੇ ਸਾਹਮਣੇ ਅਤੇ ਆਪਾਂ ਇੱਕ ਆਪਣੇ ਆਜ਼ਾਦੀ ਸੰਗਰਾਮੀ ਦੀ ਦਿੱਤੀ ਹੋਈ ਆਜ਼ਾਦੀ ਬਾਰੇ ਚਾਨਣਾ ਪਾਵਾਂਗੇ ਹਾਂਜੀ ਬਸ ਮੈਂ ਇਹੀ ਕਹਿਣਾ ਸੀਗਾ ਇਸ ਕਰਕੇ ਤੁਸੀਂ ਠੀਕ ਆ ਹੁਣ ਤੁਸੀਂ ਤਿਆਰ ਕਰ ਲਿਓ ਦੋ ਤਿੰਨ ਦਿਨ ਤੱਕ ਆ ਕੇ ਨਾ ਮੈਨੂੰ ਚੈੱਕ ਕਰਵਾ ਦਿਓ ਫਿਰ ਮੈਂ ਤੁਹਾਨੂੰ ਦੱਸ ਦਵਾਂਗੀ ਜੇ ਕੋਈ ਉਹਦੇ ਵਿੱਚ ਤਰੁਟੀ ਹੋਵੇਗੀ ਤਾਂ ਠੀਕ ਹੈ ਬੱਚੇ ਓਕੇ ਟੇਕ ਕੇਅਰ ਓਕ